ਸਾਡੇ ਖੇਤਰ ਵਿੱਚ ਬਹੁਤ ਤਰ੍ਹਾਂ ਦੇ ਅਲੱਗ ਅਲੱਗ ਸਕੂਲ ਕੋਲਜ ਅਤੇ ਸੰਸਥਾਵਾਂ ਹਨ ਜਿਹੜੀਆਂ ਕਿ ਵਿਦਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਜਿਹੜੇ ਕਿ ਕਲਾ ਦੀ ਸਿਖਲਾਈ ਅਤੇ ਵਿੱਦਿਅਕ ਪ੍ਰੋਗਰਾਮ ਜਿਹੜੇ ਕਿ ਸਿਖਾਉਂਦੀ ਹੈ ਅਤੇ ਉਨ੍ਹਾਂ ਨੂੰ ਅੱਗੇ ਉਨ੍ਹਾਂ ਦੇ ਫਿਊਚਰ ਜ ਵਿੱਚ ਜਾਣ ਲਈ ਬਹੁਤ ਜ਼ਿਆਦਾ ਜਿਹੜੀ ਕਿ ਸਹਾਇਤਾ ਕਰਦੀ ਹੈ ਅਤੇ ਇਹ ਉਨ੍ਹਾਂ ਦੀ ਮਿਹਨਤ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਇਹ ਸਾਰਾ ਕੁਝ ਕਰਦੇ ਹਨ ਜਿਨ ਜਿੱਦਾਂ ਕਿ ਬੱਚਿਆਂ ਨੂੰ ਅਲੱਗ ਪ੍ਰਕਾਰ ਦੀ ਡਰਾਇੰਗ ਸਿਖਾਈ ਜਾਂਦੀ ਹੈ ਪੇਟਿੰਗ ਸਿਖਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਮਿਊਜ਼ਿਕ ਬਾਰੇ ਦੱਸਿਆ ਜਾਂਦਾ ਹੈ ਹਰਮੋਨੀਅਮ ਬਾਰੇ ਦੱਸਿਆ ਜਾਂਦਾ ਹੈ ਅਤੇ ਅੱਗੇ ਜਾ ਕੇ ਮਿਊਜ਼ਿਕ ਦਾ ਜਿਹੜਾ ਕਿ ਇੰਸਟਰੂਮੈਂਟ ਕਰ ਸਕਦੇ ਨੇ ਅਤੇ ਅਲੱਗ ਅਲੱਗ ਇੰਸਟਰੂਮੈਂਟ ਹੁੰਦੇ ਨੇ ਜਿੱਦਾਂ ਕਿ ਤਬਲਾ ਅਤੇ ਵਾਇਲਨ ਅਤੇ ਸਾਰਾ ਕੁਝ ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਜਿਸ ਨਾਲ਼ ਉਹ ਅੱਗੇ ਆਪਣੇ ਫਿਊਚਰ 'ਚ ਮਿਊਜ਼ਿਕ ਦੇ ਬਾਰੇ ਇੰਟਰਸਟਿੰਗ ਨੇ ਤਾਂ ਉਹ ਆਪਣਾ ਮਿਊਜ਼ਕ ਅੱਗੇ ਕੈਰੀਅਰ ਜਿਹੜਾ ਕਿ ਸਾਂਭ ਸਕਦੇ ਨੇ ਅਤੇ ਉਹਦੇ 'ਚ ਆਪਣਾ ਇਨਕਮ ਦਾ ਸਾਧਨ ਉਨ੍ਹਾਂ ਨੂੰ ਬਣਾ ਸਕਦੇ ਨੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਕਿ ਕਲਾਵਾਂ ਸਿਖਾਈਆਂ ਜਾਂਦੀਆਂ ਨੇ ਬੱਚਿਆਂ ਨੂੰ ਜਿੱਦਾਂ ਕਿ ਹੁਣ ਡਰਾ ਜਿਹੜੇ ਕਿ ਚਿੱਤਰਕਾਰੀ ਹੋ ਗਈ ਅਤੇ ਉਹ ਬਹੁਤ ਵਧੀਆ ਤਰੀਕੇ ਨਾਲ਼ ਬੱਚਿਆਂ ਨੂੰ ਸਿਖਾਈ ਜਾਂਦੀ ਹੈ ਅਤੇ ਉਹ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਇਸ ਨਾਲ ਪੈਸਾ ਕਮਾ ਸਕਦੇ ਹਨ ਕਿਉਂਕਿ ਅੱਜ ਕੱਲ੍ਹ ਜਿਹੜੇ ਕਿ ਲੋਕ ਨੇ ਉਹ ਚਿੱਤਰਕਾਰੀ ਆਪਣੇ ਦੀਵਾਰਾਂ 'ਤੇ ਲਗਾਉਂਦੇ ਨੇ ਅਤੇ ਉਨ੍ਹਾਂ ਨਾਲ਼ ਉਨ੍ਹਾਂ ਦੀ ਸ਼ੋਭਾ ਬਣਦੀ ਹੈ ਅਤੇ ਥੋੜ੍ਹਾ ਜਿਹਾ ਜਿਹੜਾ ਕਿ ਰਿਚ ਫੀਲਿੰਗ ਉਨ੍ਹਾਂ ਨੂੰ ਆਉਂਦੀ ਹੈਗੀ ਆ ਅਤੇ ਬੱਚਿਆਂ ਨੂੰ ਸਿਲਾਈ ਦਾ ਵੀ ਦੱਸਿਆ ਜਾਂਦਾ ਹੈ ਕਢਾਈ ਸਿਲਾਈ ਇਹ ਸਾਰਾ ਵੀ ਉਨ੍ਹਾਂ ਦੇ ਘਰੇਲੂ ਅਤੇ ਬਾਹਰ ਸਾਰੇ ਕਿਤੇ ਉਨ੍ਹਾਂ ਲਈ ਕੰਮ ਆਉਂਦਾ ਹੈ ਅਤੇ ਬੱਚਿਆਂ ਨੂੰ ਅਲੱਗ ਅਲੱਗ ਸੰਸਥਾਵਾਂ ਬਾਰੇ ਵੀ ਦੱਸਿਆ ਜਾਂਦਾ ਹੈ